ਸਾਡੀ ਰਸੋਈ ਵਿੱਚ ਫਰਿੱਜ ਹੈ ਮਿਕਸਰ ਹੈ ਮਿਕਸੀ ਹੈ ਉਹ ਤੋਂ ਬਾਅਦ ਆਪਣਾ ਗੈਸ ਚੁੱਲ੍ਹਾ ਹੈ ਪਹਿਲਾਂ ਪੁਰਾਣੇ ਜ਼ਮਾਨੇ ਦੇ ਮੁਕਾਬਲੇ ਗੈਸ ਚੁੱਲ੍ਹੇ ਦੀ ਜਗ੍ਹਾ ਅਸੀਂ ਲੱਕੜੀ ਅਤੇ ਪਾਥੀਆਂ ਦਾ ਇਸਤੇਮਾਲ ਕਰਦੇ ਸੀਗੇ ਫਰਿੱਜ ਦੇ ਵ ਅਸੀਂ ਬਰਫ ਦਾ ਇਸਤੇਮਾਲ ਕਰਦੇ ਸੀਗੇ ਔਰ ਮਿਕਸ ਕਰਨ ਵਾਸਤੇ ਕਿਸੇ ਚੀਜ਼ ਨੂੰ ਅਸੀਂ ਕੂੰਡੀ ਸੋਟੇ ਦਾ ਇਸਤੇਮਾਲ ਕਰਦੇ ਰਹੇ ਹਾਂ ਔਰ ਪੁਰਾਣੇ ਜ਼ਮਾਨੇ ਦੇ ਮੁਕਾਬਲੇ ਹੁਣ ਥੋੜ੍ਹਾ ਤੇਜ਼ੀ ਨਾਲ ਕੰਮ ਹੋ ਜਾਂਦਾ ਪਹਿਲਾਂ ਚੁੱਲ੍ਹੇ ਦੇ ਵਿੱਚ ਫੂਕਾਂ ਮਾਰ ਮਾਰ ਕੇ ਧੂੰਏ ਨਾਲ ਪਰੋਬਲਮ ਆਉਂਦੀ ਰਹਿੰਦੀ ਸੀ